ਵਿਆਹਾਂ ਵਿੱਚ ਪਾਣੀ ਦੀ ਸੁਵਿਧਾ ਕਰਨ ਲਈ ਅੱਜ ਦੇ ਟਾਈਮ ਵਿੱਚ ਕਾਫ਼ੀ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਪਾਣੀ ਜਿਹੜਾ ਹੈ ਕਿ ਉਹਨਾਂ ਦੀ ਮਾਤਰਾ ਕਾਫ਼ੀ ਘੱਟਦੀ ਜਾ ਰਹੀ ਆ ਅਤੇ ਕਾਫ਼ੀ ਲੋਕ ਉਸ ਦਾ ਪ੍ਰਬੰਧ ਕਰਨ ਲਈ ਵੱਖਰੀ ਵੱਖਰੀ ਚੀਜ਼ਾਂ ਕਰਦੇ ਹਨ ਜਿੱਦਾਂ ਟੈਂਕਰ ਵਿੱਚ ਪਾਣੀ ਮੰਗਵਾ ਲੈਂਦੇ ਹਨ ਅਤੇ ਜਾਂ ਉਹ ਪਾਣੀ ਦੇ ਜਿਹੜੇ ਕੱਪ ਹੈਗੇ ਉਹ ਮੰਗਵਾ ਲੈਂਦੇ ਹਨ ਕਾਫ਼ੀ ਜਿੱਦਾਂ ਹੁਣ ਲੋਕ ਟੈਂਕਰ ਮੇਨ ਲੋਕ ਪਾਣੀ ਦੇ ਕੱਪ ਜਾਂ ਟੈਂਕਰ ਹੀ ਮੰਗਵਾਉਂਦੇ ਹਨ ਜਿਸ ਨਾਲ ਉਹਨਾਂ ਨੂੰ ਉਹਨਾਂ ਦਾ ਵਿਆਹ ਭੁਗਤ ਜਾਵੇ ਕਿਉਂਕਿ ਪਾਣੀ ਕਾਫ਼ੀ ਜ਼ਰੂਰੀ ਹੈ ਪਾਣੀ ਤੋਂ ਬਿਨਾਂ ਨਾ ਕੋਈ ਤੁਰ ਸਕਦਾ ਨਾ ਤਾਂ ਕੁਛ ਕਿਉਂਕਿ ਪਾਣੀ ਪੀ ਕੇ ਹੀ ਲੋਕਾਂ ਨੂੰ ਅੱਜ ਦੇ ਟੈਮ ਕਿਉਂਕਿ ਵਿਆਹ ਵਿੱਚ ਲੋਕਾਂ ਨੇ ਰੋਟੀ ਖਾਣੀ ਹੁੰਦੀ ਹੈ ਉਹਨਾਂ ਨੂੰ ਪਿਆਸ ਲੱਗਦੀ ਹੈ ਜਾਂ ਮਿਰਚ ਲੱਗਦੀ ਹੈ ਅਤੇ ਰੋਟੀ ਖਾਣ ਨਾਲ ਪਾਣੀ ਵੀ ਚਾਹੀਦਾ ਹੈ ਇਸ ਕਰਕੇ ਵਿਆਹਾਂ ਵਿੱਚ ਪਾਣੀ ਬਹੁਤ ਜ਼ਰੂਰੀ ਹੈ ਅਤੇ ਪਾਣੀ ਨੂੰ ਕੋਸ਼ਿਸ਼ ਲਿਆਉਣ ਲਈ ਅਤੇ ਲੋਕਾਂ ਨੂੰ ਕਾਫ਼ੀ ਦਿੱਕਤ ਕਰਨੀ ਪੈਂਦੀ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਾਣੀ ਨੂੰ ਵੱਧ ਤੋਂ ਵੱਧ ਤੋਂ ਵੱਧ ਉਹਨਾਂ ਦੀ ਉਹਨਾਂ ਨੂੰ ਪਹੁੰਚਾਇਆ ਜਾਵੇ ਉਹਨਾਂ ਦੀ ਪਾਣੀ ਦਾ ਮਤਲਬ ਕਿਹੜੀ ਹੈਗੀ ਪ੍ਰਬੰਧ ਕੀਤਾ ਜਾਵੇ ਵਿਆਹਾਂ ਵਿੱਚ ਇਸ ਕਰਕੇ ਸਾਨੂੰ ਪਾਣੀ ਨੂੰ ਬਚਾਉਣਾ ਵੀ ਚਾਹੀਦਾ ਹੈ ਅਤੇ ਪਾਣੀ ਦੀ ਲੋੜ ਵੀ ਬਹੁਤ ਹੈ ਬਚਾਉਣ ਲਈ ਜਿਹੜੇ ਅੱਜ ਕੱਲ੍ਹ ਲੋਕ ਜਿਸ ਤਰ੍ਹਾਂ ਹੁਣ ਪਾਣੀ ਨੂੰ ਇਸ ਤਰ੍ਹਾਂ ਖੁੱਲ੍ਹਾ ਛੱਡ ਦਿੰਦੇ ਹਨ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਨ ਜਿਸ ਤਰ੍ਹਾਂ ਪਾਣੀ ਘੱਟਦਾ ਜਾ ਰਿਹਾ ਤੋ ਜਿਹੜੀ ਚੀਜ਼ ਉਹਨਾਂ ਨੂੰ ਜ਼ਰੂਰੀ ਹੈ ਉਹਦੇ ਵਿੱਚ ਯੂਜ਼ ਨਹੀਂ ਕਰਨਗੇ ਜਿਹੜੀ ਫਾਲਤੂ ਚੀਜ਼ਾਂ ਉਹਦੇ ਵਿੱਚ ਯੂਜ਼ ਕਰਦੇ ਰਹਿਣਗੇ ਇਸ ਕਰਕੇ ਸਾਨੂੰ ਪਾਣੀ ਦੀ ਵਰਤੋਂ ਖਰਾਬ ਚੀਜ਼ਾਂ ਵਿੱਚ ਨਹੀਂ ਕਰਨੀ ਹੈ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਦੇ 'ਚ ਤਾਂ ਕਰਨੀ ਔ ਪੈਣੀ ਹੈ ਇਸ ਕਰਕੇ ਸਾਨੂੰ ਵਿਆਹਾਂ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਸਾਨੂੰ ਸਰਕਾਰ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਵੱਧ ਤੋਂ ਵੱਧ ਕੀਤਾ ਜਾਵੇ ਲੋਕਾਂ ਨੂੰ ਵਿਆਹਾਂ ਵਿੱਚੋਂ ਦਿੱਕਤ ਆਉਂਦੀ ਹੈ ਪਾਣੀ ਦੀ ਉਹ ਘੱਟ ਜਾਵੇ ਕਿਉਂਕਿ ਜਿਹੜਾ ਗਰੀਬ ਬੰਦਾ ਉਹਨਾਂ ਨੇ ਪਾਣੀ ਅੱਜ ਕੱਲ੍ਹ ਦਿੰਦੇ ਵੀ ਬਹੁਤ ਮਹਿੰਗਾ ਪਏ ਆ ਇਸ ਤਰ੍ਹਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਪਾਣੀ ਨੂੰ ਘੱਟ ਦਾਮ ਵਿੱਚ ਅਤੇ ਜ਼ਿਆਦਾ ਦੇਣਾ ਦੀ ਲੋੜ ਹੈ